ਮੈਂ ਹਾਲ ਹੀ ਵਿੱਚ ਬਠਿੰਡਾ ਸ਼ਹਿਰ ਵਿੱਚ ਰਹਿ ਰਹੀ ਹਾਂ ਮੈਨੂੰ ਮੇਰੇ ਇਨਕਮ ਟੈਕਸ ਰਿਕਾਰਡ ਵਿੱਚ ਬਠਿੰਡਾ ਦਾ ਨਵਾਂ ਪਤਾ ਜਿੱਥੇ ਮੈਂ ਰਹਿ ਰਹੀ ਹਾਂ ਅਤੇ ਆਪਣਾ ਨਵਾਂ ਫੋਨ ਨੰਬਰ ਅਪਡੇਟ ਕਰਵਾਉਣਾ ਚਾਹੁੰਦੀ ਹਾਂ ਇਨਕਮ ਟੈਕਸ ਰਿਕਾਰਡ ਦੇ ਵਿੱਚ ਆਪਣਾ ਰਿਕਾਰਡ ਅਪਡੇਟ ਕਰਵਾਉਣਾ ਲਾਜ਼ਮੀ ਹੁੰਦਾ ਹੈ ਮੈਂ ਆਸ ਕਰਦੀ ਹਾਂ ਕਿ ਇਨਕਮ ਟੈਕਸ ਵਿਭਾਗ ਮੇਰਾ ਨਵਾਂ ਪਤਾ ਅਤੇ ਨਵਾਂ ਫੋਨ ਨੰਬਰ ਜਲਦ ਅਪਡੇਟ ਕਰ ਦੇਣਗੇ